ਵੈਸੇ ਤਾਂ ਸਾਡੇ ਖੇਤਰ ਨੂੰ ਚਲਾਉਣ ਵਾਲੀਆਂ ਬਹੁਤ ਸਾਰੀਆਂ ਪਾਰਟੀਆਂ ਹਨ ਬਟ ਕੁਝ ਮੁੱਖ ਸਿਆਸੀ ਪਾਰਟੀਆਂ ਨੇ ਜੋ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪ ਆਮ ਆਦਮੀ ਪਾਰਟੀ ਅਤੇ ਭਾਜਪਾ ਭਾਜਪਾ ਪਾਰਟੀਆਂ ਅਤੇ ਕਾਂਗਰਸ ਪਾਰਟੀਆਂ ਸ਼ਾਮਿਲ ਹਨ ਜ ਜੋ ਕਿ ਹਾਂ ਬਹੁਤ ਲੰਬੇ ਸਮੇਂ ਤੋਂ ਪੰਜਾਬ ਉੱਤੇ ਰਾਜ ਕਰਦੀਆਂ ਆ ਰਹੀਆਂ ਨੇ ਸਾਡੇ ਹੁਣ ਜੋ ਕਿ ਹੈ ਮੁੱਖ ਪਾਰਟੀ ਜੋ ਹੈ ਮੁੱਖ ਸਿਆਸੀ ਪਾਰਟੀ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦੀ ਜੋ ਕਿ ਉੱਨੀ ਸੌ ਵੀਹ ਵਿੱਚ ਸਟਾਰਟ ਹੋਈ ਸੀ ਅਤੇ ਅੱਜ ਲਗਭਗ ਲਗਭਗ ਉਹਨਾਂ ਨੂੰ ਸੌ ਸਾਲ ਹੋ ਚੁੱਕੇ ਹਨ ਅਤੇ ਇੱਥੋਂ ਦੇ ਇਸਦੇ ਮੋਢੀ ਜੋ ਸਨ ਪ੍ਰਕਾਸ਼ ਸਿੰਘ ਬਾਦਲ ਸਨ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਪੰਜਾਬ ਵਿੱਚ ਬਹੁਤ ਸਾਰਾ ਵਿਕਾਸ ਕੀਤਾ ਉਹਨਾਂ ਦੀ ਅੱਜ ਸਾਡੇ ਹੁਣ ਅੱਜ ਦੇ ਮੌਜੂਦਾ ਟਾਈਮ ਦੇ ਵਿੱਚ ਜੋ ਹੈ ਪੰਜਾਬ ਦਾ ਹੁਣ ਅੱਜ ਕੱਲ੍ਹ ਮੋਢੀ ਹੈ ਉਹ ਹਰਸਿਮਰਤ ਕੌਰ ਬਾਦਲ ਨੇ ਅਤੇ ਇਹ ਹੁਣ ਪੰਜਾਬ ਦਾ ਵਿਕਾਸ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੁਣ ਸਾਡੇ ਮੌਜੂਦਾ ਸਰਕਾਰ ਜੋ ਹੈ ਆਮ ਆਦਮੀ ਪਾਰਟੀ ਹੈ ਜਿੱਥੋਂ ਦੇ ਜਿਸ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਭਗਵੰਤ ਸਿੰਘ ਮਾਨ ਨੇ ਅਤੇ ਇਹ ਵੀ ਪੰਜਾਬ ਦਾ ਵਿਕਾਸ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰ ਰਹੇ ਹਨ ਇਹ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਇਹਨਾਂ ਦੇ ਉਸ ਤੋਂ ਇਲਾਵਾ ਸਾਡੇ ਖੇਤਰ ਵਿੱਚ ਹੋਰ ਵੀ ਭਾਸ਼ਾਵਾਂ ਹੋਰ ਵੀ ਸਿਆਸੀ ਪਾਰਟੀਆਂ ਨੇ ਜਿਵੇਂ ਕਿ ਭਾਜਪਾ ਅਤੇ ਕਾਂਗਰਸ ਜੋ ਕਿ ਲਗਭਗ ਸੱਠ ਸੱਤਰ ਸਾਲ ਤੋਂ ਹੀ ਇਸ 'ਤੇ ਰਾਜ ਕਰ ਰਹੀਆਂ ਹਨ ਅਤੇ ਸਾਡੇ ਹੋ ਕੇਂਦਰ ਸਰਕਾਰ ਜੋ ਹੈ ਕਿ ਭਾਜਪਾ ਹੈ ਅਤੇ ਉਸ ਤੋਂ ਬਾਅਦ ਸਾਨੂੰ ਕਾਂਗਰਸ ਦਾ ਵੀ ਇੱਥੇ ਰਾਜ ਹੋਇਆ ਅਤੇ ਕਾਂਗਰਸ ਨੇ ਵੀ ਇੱਥੇ ਵਿਕਾਸ ਕੀਤਾ ਅਤੇ ਭਾਜਪਾ ਉਸ ਤੋਂ ਬਾਅਦ ਭਾਜਪਾ ਵੀ ਆਏ ਅਤੇ ਜਿਨ੍ਹਾਂ ਦੇ ਮੋਢੀ ਮ ਮੋਦੀ ਸਰਕਾਰ ਮੋਦੀ ਸਰਕਾਰ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਅਤੇ ਇਹਨਾਂ ਨੇ ਵੀ ਉਹ ਪੰਜਾਬ ਵਿੱਚ ਵਿਕ ਆਪਣਾ ਵਿਕਾਸ ਕਰਨਾ ਚਾਹਿਆ ਅਤੇ ਹੁਣ ਜੋ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈ ਅਤੇ ਹੁਣ ਉਹ ਵੀ ਬਹੁਤ ਜ਼ਿਆਦਾ ਵਿਕਾਸ ਕਰ ਰਹੀ ਹੈ ਅਤੇ ਇਹਨਾਂ ਨਾਲ ਸਾਡੇ ਇਹਨਾਂ ਦਾ ਗਠਨ ਜੋ ਹੋਇਆ ਕੁਝ ਪਾਰਟੀਆਂ ਅਜਿਹੀਆਂ ਸਨ ਜੋ ਕਿ ਪੰਜਾਬ ਦਾ ਵਿਕਾਸ ਕਰਨ ਵਿੱਚ ਸਕਸ਼ਮ ਨਹੀਂ ਸਨ ਅਤੇ ਇਸ ਲਈ ਇਹਨਾਂ ਨੇ ਪਾਰਟੀਆਂ ਨੇ ਆਪਣਾ ਗਠਨ ਕੀਤਾ ਤਾਂ ਕਿ ਇਹ ਪੰਜਾਬ ਨੂੰ ਹੋਰ ਤਰੱਕੀ ਦੇ ਰਾਹ 'ਤੇ ਲਿਜਾ ਸਕਣ ਧੰਨਵਾਦ